ਹਾਂਜੀ ਓਲਾ ਕੰਪਨੀ ਦੇ ਡਰਾਇਵਰ ਸੁਰੇਸ਼ ਸਿੰਘ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਹੈ ਸਾਨੂੰ ਸਹੀ ਟਾਈਮ 'ਤੇ ਔਰ ਸਹੀ ਜਗ੍ਹਾ 'ਤੇ ਪਹੁੰਚਾ ਦਿੱਤਾ ਔਰ ਜੋ ਵੀ ਸਾਡਾ ਸਮਾਨ ਸੀ ਉਸਨੂੰ ਬੜੇ ਹੀ ਬ ਨਿਮਰ ਸੁਭਾਅ ਦੇ ਨਾਲ ਆਪ ਚੱਕ ਕੇ ਗੱਡੀ ਵਿੱਚ ਰੱਖੇ ਰੱਖਿਆ ਅਤੇ ਆਪ ਹੀ ਉਤਾਰਿਆ ਅਤੇ ਬਾਕੀ ਸਾਨੂੰ ਉਹਨਾਂ ਦੇ ਨਾਲ ਆਉਂਦੇ ਸਮੇਂ ਬਿਲਕੁਲ ਵੀ ਡਰ ਨਹੀਂ ਲੱਗਿਆ ਇੱਕ ਸਾਨੂੰ ਲੱਗਦਾ ਸੀ ਕਿ ਅਸੀਂ ਕਿਸੇ ਚੰਗੇ ਬੰਦੇ ਦੇ ਨਾਲ ਬੈਠੇ ਹਾਂ